ਪੰਜਾਬ ਵਿੱਚ ਮੌਸਮ ਹਰੇਕ ਤਰ੍ਹਾਂ ਦਾ ਆਉਂਦਾ ਏ ਇੱਥੇ ਗਰਮੀਆਂ ਵੀ ਆਉਂਦੀਆਂ ਹਨ ਅਤੇ ਸਰਦੀਆਂ ਵੀ ਆਉਂਦੀਆਂ ਹਨ ਗਰਮੀਆਂ ਦੇ ਮੌਸਮ ਵਿੱਚ ਸਾਨੂੰ ਬਹੁਤ ਪ੍ਰਹੇਜ਼ ਕਰਨਾ ਚਾਹੀਦਾ ਹੈ ਗਰਮੀ ਦੇ ਮੌਸਮ ਵਿੱਚ ਸਵੇਰੇ ਜਾਂ ਸ਼ਾਮ ਨੂੰ ਨਿਕਲਣਾ ਚਾਹੀਦਾ ਹਨ ਦੁਪਹਿਰ ਨੂੰ ਬਹੁ ਬਹੁਤ ਘੱਟ ਨਿਕਲਣਾ ਚਾਹੀਦਾ ਹੈ ਇੱ ਇੱਥੇ ਜਿਹੜਾ ਏ ਗਰਮੀਆਂ ਵਿੱਚ ਖਾਣ ਪੀਣ ਦਾ ਜਿਹੜਾ ਪ੍ਰਹੇਜ਼ ਹੈ ਬਹੁਤ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਇਸ ਵਿੱਚ ਸਾਨੂੰ ਬਹੁਤ ਹੀ ਲਿਕੁਅਡ ਚੀਜ਼ਾਂ ਪੀਣੀਆਂ ਚਾਹੀਦੀਆਂ ਹਨ ਪਹਿਰਾਵਾ ਸਾਨੂੰ ਕੋਟਨ ਸਿੰਪਲ ਕੱਪੜਾ ਪਾਉਣਾ ਚਾਹੀਦਾ ਹੈ ਜੋ ਕਿ ਸਾਡੇ ਲਈ ਵੀ ਠੀਕ ਹੈ ਅਤੇ ਸਾਡੇ ਪਰਿਵਾਰ ਲਈ ਵੀ ਠੀਕ ਹੈ ਸਾਉਣ ਅ ਦੇ ਮਹੀਨੇ ਵਿੱਚ ਪਾਣੀ ਦੀ ਨਿਕਾਸੀ ਵਿੱਚ ਜਦੋਂ ਬਰਸਾਤਾਂ ਦਾ ਪਾਣੀ ਆਉਂਦਾ ਹੈ ਉਸ ਵਿੱਚ ਗਲੀਆਂ ਮੁਹੱਲੇ ਵਿੱਚ ਪਾਣੀ ਬਹੁਤ ਭਰ ਜਾਂਦਾ ਹਨ ਜਿਸ ਲਈ ਉਸ ਤੋਂ ਸਾਨੂੰ ਬਾਹਰ ਜਾਣ ਲਈ ਗੱਡੀ ਦੀ ਵਰਤੋਂ ਕਰਨੀ ਚਾਹੀਦੀ ਹੈ ਸਰਦੀਆਂ ਦੇ ਮੌਸਮ ਵਿੱਚ ਘਰ ਵਿੱਚ ਠੰਡ ਵਿੱਚ ਬਚਣ ਨਾਲੋਂ ਘਰ ਵਿੱਚ ਰਹਿਣਾ ਚਾਹੀਦਾ ਹੈ ਅਤੇ ਬਾਹਰ ਨਿਕਲਣ ਸਮੇਂ ਸਾਨੂੰ ਧੁੰ ਧੁੰਦ ਤੋਂ ਬਚਣ ਲਈ ਪ੍ਰਹੇਜ ਕਰਨਾ ਚਾਹੀਦਾ ਹੈ